ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਲਵਪ੍ਰੀਤ ਬੋਲਦੇ ਓਂ ਹਾਂਜੀ ਸਰ ਮੈਂ ਮੇਰਾ ਇੱਕ ਯੂਟਿਊਬ ਚੈਨਲ ਆ ਫੂਡ ਵਿਦ ਅੱਸ ਸਰ ਮੈਂ ਉਰੇ ਪੰਜਾਬ ਵਿੱਚ ਵਿਜਿਟ ਕਰਨਾ ਸੀ ਸਰ ਮੈਨੂੰ ਤੁਸੀਂ ਦੱਸ ਸਕਦੇ ਹੋ ਵੀ ਕੀ ਕੀ ਉਰੇ ਮਿਲਦਾ ਏ ਹਾਂਜੀ ਸਰ ਹਾਂਜੀ ਸਰ ਇਹ ਤੋਂ ਇਲਾਵਾ ਸਰ ਹੋਰ ਕੀ ਕੀ ਮਿਲਦਾ ਠੀਕ ਹੈ ਸਰ ਹੋਰ ਕੋਈ ਦੱਸ ਸਕਦੇ ਸਰ ਠੀਕ ਹੈ ਸਰ ਹਾਂਜੀ ਸਰ ਮੈਂ ਇੱਕ ਅੱਧੇ ਦਿਨ 'ਚ ਇੱਥੇ ਵਿਜਿਟ ਕਰਨਾ ਏ ਫਿਰ ਫਿਰ ਮੇ ਮੈਂ ਤੁਹਾਨੂੰ ਕਾਲ ਕਰੂੰਗੀ ਤੁਸੀਂ ਫਿਰ ਮੈਨੂੰ ਦੱਸ ਦਿਓ ਵੀ ਕੀ ਕੀ ਇੱਕ ਅੱਧੇ ਦਿਨ 'ਚ ਸਰ ਵਿਜਿਟ ਕਰਨਾ ਮੈਂ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਥੈਂਕ ਯੂ ਸਰ ਦੱਸਣ ਲਈ ਹਾਂਜੀ ਸਰ ਥੈਂਕ ਯੂ ਸਰ